ਭੰਗੜਾ ਮੁੰਡੇ ਕੁੜੀਆਂ ਦਾ ਬਹੁਤ ਵਧੀਆ ਮਹੱਤਵ ਹੈ ਭੰਗੜਾ ਲੋਹੜੀ 'ਤੇ ਪਾਇਆ ਜਾਂਦਾ ਹੈ ਅਤੇ ਮੁੰਡੇ ਕੁੜੀਆਂ ਇਕੱਠੇ ਭੰਗੜਾ ਪਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ ਅਤੇ ਪੰਜਾਬੀਆਂ ਦਾ ਸੱਭਿਆਚਾਰ ਭੰਗੜਾ ਹੈ ਅਤੇ ਭੰਗੜੇ ਵਿੱਚ ਪੈਰ ਪੁੱਟੇ ਜਾਂਦੇ ਹਨ ਅਤੇ ਹੱਥ ਉੱਚੇ ਕਰਕੇ ਅਤੇ ਡਾਂਗਾ ਲੈ ਕੇ ਅਤੇ ਵਧੀਆ ਪਾਇਆ ਜਾਂਦਾ ਹੈ